ਹੈਲੋ ਸਤਿ ਸ਼੍ਰੀ ਅਕਾਲ ਮੈਂ ਸੀਮਾ ਰਾਣੀ ਬੋਲਦੀ ਹਾਂ ਹਾਂਜੀ ਸਰ ਤੁਸੀਂ ਐਮਾਜ਼ੋਨ ਤੋਂ ਬੋਲਦੇ ਹੋ ਹਾਂਜੀ ਮੈਨੇ ਨਾ ਐਮਾਜ਼ੋਨ ਤੋਂ ਨਾ ਇੱਕ ਹੈੱਡਫੋਨ ਔਡਰ ਕੀਤਾ ਸੀਗਾ ਅਤੇ ਉਹਦੇ ਐਮਾਜ਼ੌਨ 'ਚ ਬਹੁਤ ਸਾਰੇ ਕਲ ਰੰਗਾਂ ਦੇ ਪਏ ਸੀਗੇ ਹੈੱਡਫੋਨ ਉਹਨਾਂ ਵਿੱਚੋਂ ਨਾ ਇੱਕ ਰੰਗ ਮੈਨੂੰ ਪਸੰਦ ਆ ਗਿਆ ਅਤੇ ਮੈਨੇ ਅਚਾਨਕ ਹੀ ਉਹਨੂੰ ਔਡਰ ਕਰਤਾ ਉਹ ਘਰ ਵੀ ਦੇਣ ਆ ਗਏ ਔਡਰ ਉਹ ਜਿਹੜਾ ਵੀਰਾ ਸੀਗਾ ਦੇਣ ਆਏ ਸੀਗੇ ਜਿਹੜੇ ਉਹਨਾਂ ਦਾ ਵਿਵਹਾਰ ਵੀ ਬਹੁਤ ਅੱਛਾ ਸੀਗਾ ਬਹੁਤ ਵਧੀਆ ਢੰਗ ਨਾਲ ਬੋਲੇ ਰਿਸਪੈਕਟ ਨਾਲ ਬੋਲੇ ਆਪਾਂ ਵੀ ਉਹਨਾਂ ਦੀ ਪੂਰੀ ਰਿਸਪੈਕਟ ਕੀਤੀ ਅਤੇ ਅਲ ਹੈੱਡਫੋਨ ਦਾ ਕਲਰ ਬਹੁਤ ਵਧੀਆ ਸੀ ਪਿਆਰਾ ਸੀਗਾ ਮੈਨੂੰ ਬਹੁਤ ਵਧੀਆ ਲੱਗਿਆ ਜਦੋਂ ਮੈਂ ਫੋਨ 'ਤੇ ਚਲਾਏ ਹੈੱਡਫੋਨ ਉਹਨਾਂ ਦੀ ਆਵਾਜ਼ ਵੀ ਪੂਰੀ ਵਧੀਆ ਢੰਗ ਨਾਲ ਤਰੀਕੇ ਨਾਲ ਚੱਲਿਆ ਅਤੇ ਵਧੀਆ ਢੰਗ ਨਾਲ ਚੱਲਿਆ ਬਈ ਕੋਈ ਦਿੱਕਤ ਵਗੈਰਾ ਵੀ ਨਹੀਂ ਆਈ ਮੈਨੂੰ ਉਹ ਬਹੁਤ ਵਧੀਆ ਲੱਗਿਆ ਇਸ ਕਰਕੇ ਫੇਰ ਮੈਂ ਆਪਦੇ ਭੈਣ ਭਰਾਵਾਂ ਨੂੰ ਵੀ ਕਿਹਾ ਬਈ ਤੁਸੀਂ ਵੀ ਔਡਰ ਕਰ ਸਕਦੇ ਹੋ ਜੇ ਨਹੀਂ ਵੀ ਇਹ ਇੰਨਾ ਵਧੀਆ ਢੰਗ ਤਰੀਕੇ ਨਾਲ ਚੱਲਦੇ ਹੈ ਹੈੱਡਫੋਨ ਇਸ ਕਰਕੇ ਉਹਨਾਂ ਨੇ ਵੀ ਔਡਰ ਕਰਤਾ ਇਸ ਕਰਕੇ ਸਰ ਮੈਂ ਤੁਹਾਡਾ ਥੈਂਕ ਯੂ ਕਰਨਾ ਚਾਹੁੰਦੀ ਹਾਂ ਤਹਿ ਦਿਲੋਂ ਤਾਂ ਇਸ ਕਰਕੇ ਇਹ ਕਹਿਣਾ ਚਾਹੁੰਦੀ ਹਾਂ ਕਿ ਬਈ ਵਧੀਆ ਐਮਾਜ਼ੋਨ ਤੁਸੀਂ ਐਪ ਚਲਾਇਆ ਹੈਗਾ ਇਤਸ ਤੋਂ ਤਾਂ ਜੋ ਸਾਡੇ ਵਰਗੇ ਔਡਰ ਕਰ ਸਕਦੇ ਹਾਂ ਕੁਛ ਵੀ ਔਡਰ ਕਰ ਸਕਦੇ ਹਾਂ ਜ਼ਰੂਰੀ ਨਹੀਂ ਹੈੱਡਫੋਨ ਉਸ ਤੋਂ ਵੀ ਵਧੀਆ ਕੋਈ ਵੀ ਟੂਲਸ ਵਗੈਰਾ ਗੈਜਟ ਵਗੈਰਾ ਟੋਇਸ ਵਗੈਰਾ ਔਡਰ ਕਰ ਸਕਦੇ ਹਾਂ ਬਹੁਤ ਵਧੀਆ ਅੱਛਾ ਪ੍ਰੋਡਕਟ ਹੈਗੇ ਸਾਰੇ